ਹਾਂਜੀ ਮੈਂ ਤੈਰਾਕੀ ਸਿੱਖਣ ਵਿੱਚ ਕਈਆਂ ਦੀ ਮਦਦ ਕਰ ਚੁੱਕੀ ਹਾਂ ਅਤੇ ਇੱਕ ਵਾਰ ਫਸੀ ਸੀ ਮੈਂ ਇਹੋ ਜਿਹੀ ਮੁਸ਼ਕਿਲ ਸਥਿਤੀ ਵਿੱਚ ਇੱਕ ਬੱਚਾ ਛੋਟਾ ਸੀਗਾ ਜਿਹੜਾ ਮਤਲਬ ਉਹ ਫਸਟ ਟਾਈਮ ਜਦੋਂ ਉਤਰਿਆ ਅਤੇ ਉਹ ਪੇਰੈਂਟਸ ਦਾ ਧਿਆਨ ਵੰਡਿਆ ਗਿਆ ਅਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਅਤੇ ਉਹ ਬੱਚਾ ਡੁੱਬਣ ਲੱਗ ਗਿਆ ਸੀ ਅਤੇ ਅਚਾਨਕ ਹੀ ਮੈਂ ਉਹਨੂੰ ਦੇਖਿਆ ਅਤੇ ਮੈਂ ਫਟਾਫਟ ਉੱਥੇ ਗਈ ਉਹਨੂੰ ਬੱਚੇ ਨੂੰ ਬਾਹਰ ਕੱਢਿਆ ਅਤੇ ਬੱਚਾ ਵੀ ਡਰ ਦੇ ਮਾਰੇ ਬੇਹੋਸ਼ ਹੋ ਚੁੱਕਿਆ ਸੀ ਅਸੀਂ ਉਹਨੂੰ ਬਾਹਰ ਕੱਢ ਕੇ ਉਹਦੇ ਪੇਟ ਦਾ ਦਬਾਕੇ ਪਾਣੀ ਵਗੈਰਾ ਕੱਢਿਆ ਤਾਂ ਕਿ ਉਹ ਲ ਸਾਹ ਪਰੋਪਰ ਲੈ ਸਕੇ ਸੋ ਇੱਦਾਂ ਮਤਲਬ ਕੀਤੀ ਮੈਂ ਕਿਸੇ ਦੀ ਮਦਦ